ਹੈਲੋ ਹਾਂਜੀ ਨਮਸਕਾਰ ਮੈਮ ਹਾਂਜੀ ਮੈਮ ਮੈਂ ਤੁਹਾਨੂੰ ਕੋਲ ਇਸ ਕਰਕੇ ਕੀਤੀ ਹੈ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਸੀ ਕਿ ਮੈਂ ਮਤਲਬ ਕਿ ਆਊਟਿੰਗ 'ਤੇ ਆਈ ਹੋਈ ਹਾਂ ਅਤੇ ਪੰਜਾਬ ਦੇ ਵਿੱਚ ਜਿਸ ਅਤੇ ਮੈਂ ਦੇਖਣਾ ਚਾਹੁੰਦੀ ਹੁਣ ਮੈਂ ਇੱਥੇ ਪਠਾਨਕੋਟ ਪਹੁੰਚੀ ਹਾਂ ਅਤੇ ਤੁਹਾਡੇ ਕੋਲ ਪੁੱਛਣਾ ਸੀ ਕਿ ਪਠਾਨਕੋਟ 'ਚ ਕੋਈ ਵੇਖਣ ਵਾਲੇ ਮਤਲਬ ਜਗ੍ਹਾ ਜਿਹੜੀਆਂ ਪਲੀਜ਼ ਮੈਨੂੰ ਦੱਸਿਓ ਤੁਸੀਂ ਕਿ ਕਿਹੜੀ ਕਿਹੜੀ ਫੇਮਸ ਜਗ੍ਹਾ ਜਿੱਥੇ ਅਸੀਂ ਘੁੰਮ ਸਕਦੇ ਹਾਂ ਹਾਂਜੀ ਓਕੇ ਜੀ ਥੈਂਕ ਯੂ ਹਾਂਜੀ ਮੈਮ ਹਾਂਜੀ ਜੀ ਜੀ ਓਕੇ ਜੀ ਜੀ ਜੀ ਠੀਕ ਹੈ ਓਕੇ ਮੈਮ ਠੀਕ ਹੈ ਠੀਕ ਹੈ ਠੀਕ ਹੈ ਮੈਮ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਮੈਮ ਔਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਮੈਮ ਅਗਰ ਜਾਣ ਦੀ ਸੁਵਿਧਾ ਵਾਸਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹਵਾਂ ਕਿ ਫਿਰ ਅਸੀਂ ਮਤਲਬ ਜਾਂ ਆਪਣੀ ਟੈਕਸੀ ਕਰਕੇ ਆਈਏ ਜਾਂ ਫਿਰ ਬੱਸ ਵਗੈਰਾ ਦੇ ਉੱਤੇ ਵੀ ਜਾ ਸਕਦੇ ਹਾਂ ਲਾਗੇ ਹੀ ਲੋਕਲ ਠੀਕ ਹੈ ਮੈਮ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਮ ਠੀਕ ਹੈ ਓਕੇ ਜੀ ਓਕੇ ਥੈਂਕ ਯੂ ਮੈਮ ਥੈਂਕ ਯੂ ਜੀ ਥੈਂਕ ਯੂ ਓਕੇ ਓਕੇ